ਘਰ ਵਿੱਚ ਖਾਣਾ ਪਕਾਉਣ ਸਮੇਂ ਐੱਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਸਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਹਨ ਜੋ ਕਿ ਸਾਨੂੰ ਵਰਤਣੀਆਂ ਚਾਹੀਦੀਆਂ ਹਨ ਸਾਨੂੰ ਵੈਂਟੀਲੇਸ਼ਨ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਵਾ ਕਰੋਸ ਹੁੰਦੀ ਰਹੇ ਸਾਨੂੰ ਖਿੜਕੀਆਂ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ ਇਸ ਤੋਂ ਸਿਵਾ ਕੋਈ ਵੀ ਅਜਿਹਾ ਕੱਪੜਾ ਨਹੀਂ ਪਾਉਣਾ ਚਾਹੀਦਾ ਜੋ ਕਿ ਅੱਗ ਦੀ ਪਕੜ ਵਿੱਚ ਜਲਦੀ ਆ ਜਾਂਦਾ ਹੈ ਅਤੇ ਸਾਨੂੰ ਪਾਈਪ ਵੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਇਸ ਤੋਂ ਇਲਾਵਾ ਰੈਗੂਲੇਟਰ ਵੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਰੈਗੂਲੇਟਰ ਦੇ ਵਿੱਚੋਂ ਕਿਤੇ ਗੈਸ ਲੀਕ ਤਾਂ ਨਹੀਂ ਹੋ ਰਹੀ ਅਤੇ ਸਿਲੰਡਰ ਲੈਂਦੇ ਸਮੇਂ ਵੀ ਸਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਕਿਤੇ ਸਿਲੰਡਰ ਦੀ ਸੀਲ ਉੱਥੋਂ ਓਪਨ ਜਾਂ ਕੁਝ ਇੱਦਾਂ ਨਹੀਂ ਹੈ ਜਿਸਦੇ ਕਰਕੇ ਸਿਲੰ ਐੱਲ ਪੀ ਜੀ ਗੈਸ ਲੀਕ ਹੁੰਦੀ ਹੋਵੇ ਇਸ ਤੋਂ ਸਿਵਾ ਵੀ ਬਹੁਤ ਸਾਰੀਆਂ ਸਾਵਧਾਨੀਆਂ ਹਨ ਜੋ ਕਿ ਸਾਨੂੰ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ ਕਈ ਪ੍ਰ ਜਿਵੇਂ ਕੁਝ ਲੋਕ ਹੁੰਦੇ ਹਨ ਜੋ ਕਿ ਬਿਲਕੁਲ ਨਹੀਂ ਡਰਦੇ ਅਤੇ ਇਸ ਪ੍ਰਕਾਰ ਹੀ ਗੈਸ ਨੂੰ ਖੁੱਲ੍ਹਾ ਛੱਡ ਦਿੰਦੇ ਹਨ ਅਤੇ ਜੋ ਕਿ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਰਾਤ ਨੂੰ ਸੌਣ ਲੱਗੇ ਵੀ ਐੱਲ ਪੀ ਜੀ ਸਿਲੰਡਰ ਨੂੰ ਰੈਗੂਲੇਟਰ ਤੋਂ ਆਫ ਕਰ ਦਈਏ ਤਾਂ ਕਿ ਗੈਸ ਫੈਲਣ ਦਾ ਵ ਪ੍ਰੋਵੀਬਿਲਟੀ ਨਾ ਰਹੇ ਅਤੇ ਨਾ ਹੀ ਕਿਸੇ ਨੂੰ ਡਰ ਹੋਵੇ ਕਿਉਂਕਿ ਅਗਰ ਕਿਉਂਕਿ ਐੱਲ ਪੀ ਜੀ ਗੈਸ ਮਨੁੱਖੀ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੀ ਹੈ ਜੋ ਕਿ ਸਾਨੂੰ ਬਹੁਤ ਨੁਕਸਾਨ ਦੇ ਸਕਦੀ ਹੈ ਸੋ ਦੱਸੀਆਂ ਹੋਈਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਕਿ ਜੋ ਸਾਡਾ ਬਚਾਅ ਹੋ ਸਕੇ